ਮੈਂ ਆਪਣੀ ਪਹਿਲੀ ਤਸਵੀਰ ਦਸਵੀਂ ਜਮਾਤ ਵਿੱਚ ਖਿੱਚੀ ਸੀ ਜਦੋਂ ਨਵੇਂ ਨਵੇਂ ਮੋਬਾਈਲ ਫੋਨ ਆਏ ਸਨ ਮੈਨੂੰ ਤਸਵੀਰ ਖਿੱਚਣਾ ਬਹੁਤ ਸ਼ੌਂਕ ਸੀ ਅਤੇ ਮੈਂ ਉਦੋਂ ਪੰਦਰ੍ਹਾਂ ਸਾਲਾਂ ਦੀ ਸਾਂ ਮੈਂ ਆਪਣੀ ਤਸਵੀਰ ਖਿੱਚ ਕੇ ਬਹੁਤ ਖੁਸ਼ ਹੋਈ